ਸਤਿ ਸ਼੍ਰੀ ਅਕਾਲ

ਹਾਂਜੀ ਪਟਿਆਲੇ 'ਚ ਵੈਸੇ ਤਾਂ ਬਹੁਤ ਕੁਛ ਹੈ ਬਹੁਤ ਪਿੰਡ ਨੇ ਸ਼ਹਿਰ ਨੇ ਦੁਕਾਨਾਂ ਨੇ ਮੰਦਰ ਨੇ ਗੁਰਦੁਆਰੇ ਨੇ ਤੁਸੀਂ ਕੀ ਪੁੱਛਣਾ ਤੁਸੀਂ ਦੱਸੋ ਖ਼ਾਸ ਚੀਜ਼ ਪਿੰਡਾਂ ਦੇ ਠੀਕ ਹੈ ਠੀਕ ਹੈ ਠੀਕ ਹੈ ਸਾਡਾ ਜਿਹੜਾ ਪਟਿਆਲਾ ਉਹਦੇ ਆਲੇ ਦੁਆਲੇ ਬਹੁਤ ਪਿੰਡ ਵੱਸਦੇ ਨੇ ਪਰ ਜਿਵੇਂ ਕਿ ਆਪਣੇ ਪਿੰਡ ਹੋ ਗਏ ਮੈਮਦਪੁਰ ਜੱਟਾਂ ਹੋ ਗਏ ਇਹ ਬਹਾਦਰਗੜ੍ਹ ਤਾਂ ਚਲੋ ਸ਼ਹਿਰ 'ਚ ਸ਼ਹਿਰ ਹੋ ਗਿਆ ਬਹਾਦਰਗੜ੍ਹ ਹੋ ਗਿਆ ਮੈਮਦਪੁਰ ਜੱਟਾਂ ਹੋ ਗਿਆ ਜ਼ੀਰਕਪੁਰ ਹੋ ਗਿਆ ਚਪੜ ਹੋ ਗਿਆ ਇਹ ਆਲੇ ਦੁਆਲੇ ਦੇ ਪਿੰਡ ਨੇ ਪਰ ਜਿਹੜਾ ਪਟਿਆਲੇ ਦੇ ਆਲੇ ਦੁਆਲੇ ਦੇ ਪਿੰਡ ਨੇ ਉੱਥੇ ਮਤਲਬ ਜ਼ਿਆਦਾਤਰ ਜਿਹੜੇ ਪਿੰਡ ਨੇ ਉਹ ਪੁਆਧ ਦੇ ਨੇ ਜਿੱਥੇ ਪੁਆਧੀ ਬੋਲੀ ਬੋਲੀ ਜਾਂਦੀ ਹੈ ਮਤਲਬ ਜਿੱਥੇ ਪਿਓਰ ਪੰਜਾਬੀ ਨਹੀਂ ਮਿਕਸ ਹਰਿਆਣਵੀ ਅਤੇ ਪੁਆਧੀ ਬੋਲੀ ਬੋਲੀ ਜਾਂਦੀ ਹੈ ਇਹ ਨੇ ਹਾਂ ਦੋਵਾਂ ਦਾ ਟੱਚ ਹੁੰਦਾ ਉਸ ਬੋਲੀ 'ਚ ਜ਼ਿਆਦਾਤਰ ਇੱਧਰ ਹੋ ਗਿਆ ਮੈਮਦਪੁਰ ਸਾਈਡ ਹੋ ਗਿਆ ਬਹਾਦਰਗੜ੍ਹ ਸ਼ੇਖਪੁਰਾ ਇਹ ਆਪਣਾ ਹੋ ਗਿਆ ਇਹ ਸਾਰੇ ਪਿੰਡ ਹੋਗੇ ਬਹਾਦਰਗੜ ਸ਼ਹਿਰ ਹੋ ਗਿਆ ਅਰਬਨ ਸਟੇਟ ਯੂਨੀਵਰਸਿਟੀ ਇਹ ਸਾਰੀ ਜਿਹੜੀ ਚੀਜ਼ਾਂ ਨੇ ਨਾ ਇਹ ਪਟਿਆਲੇ ਦੇ ਆਲੇ ਦੁਆਲੇ ਹੀ ਆਉਂਦੀਆਂ ਹੈ ਅਤੇ ਮਤਲਬ ਆਪਾਂ ਜੀ ਸੈਂਟਰ 'ਚ ਹੈ ਅਤੇ ਜਿਹੜੀ ਪਟਿਆਲੇ ਦੀ ਮੇਨ ਐਸੈਂਟ ਹੈ ਉਹ ਪੰਜਾਬੀ ਹੈ ਬਟ ਪਟਿਆਲੇ ਦੇ ਇਲਾਕਿਆਂ 'ਚ ਜਿਹੜੀ ਬੋ ਬੋਲੀ ਜਾਂਦੀ ਹੈ ਉਹ ਪੰਜਾਬੀ ਦੋ ਤਰ੍ਹਾਂ ਦੀ ਹੈ ਮਤਲਬ ਜਿਹੜੇ ਪਿੰਡ ਨੇ ਉਹ ਪੁਆਧੀ ਬੋਲਦੇ ਨੇ ਅਤੇ ਜਿਹੜੇ ਲੋਕ ਥੋੜ੍ਹੇ ਸ਼ਹਿਰ ਨੇ ਉਹ ਮਤਲਬ ਮਾਲਵੀ ਕਿਉਂਕਿ ਮਾਲਵੀ ਭਾਸ਼ਾ ਬੋਲਦੇ ਨੇ ਕਿਉਂਕਿ ਜੋ ਪਟਿਆਲਾ ਉਹ ਮਾਲਵੇ 'ਚ ਪੈਂਦਾ ਪੰਜਾਬੀ ਬੋਲਦੇ ਨੇ ਅਤੇ ਸਾਡੇ ਇੱਧਰ ਦੇ ਫੇਮਸ ਪਿੰਡ ਨੇ ਜਿਹੜੇ ਪਟਿਆਲੇ ਦੇ ਨੇੜੇ ਤੇੜੇ ਨੇ ਆਹ ਤਿੰਨ ਚਾਰ ਕੁ ਨੇ ਫਿਰ ਮੈਮਦਪੁਰ ਜੱਟਾਂ ਸ਼ੇਖਪੁਰਾ ਜ਼ੀਰਕ ਜਰੀਕਪੁਰ ਚਪੜ ਅਤੇ ਕਟਲਾ ਅਹਾਰ ਮਾਲਕਪੁਰ ਇਹ ਸਾਰੇ ਜਿਹੜੇ ਪਿੰਡ ਨੇ ਇਹ ਪਟਿਆਲੇ ਦੇ ਨੇੜੇ ਤੇੜੇ ਦੇ ਨੇ ਅਤੇ ਜਿਹੜੇ ਫੇਮਸ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਜਿਹੜੇ ਗੂਗਲ ਮੈਪਸ 'ਤੇ ਜ਼ਿਆਦਾਤਰ ਮਿਲਦੇ ਨੇ ਅਤੇ ਬਸ ਸਰ ਇਹ ਹੀ ਸਾਡੇ ਪਿੰਡ ਨੇ ਹੋਰ ਕੋਈ ਇਨਫੋਰਮੇਸ਼ਨ ਸਰ ਹਾਂਜੀ ਹੈਗੀ ਹੈ ਸਾਡੇ ਜਿਹੜੇ ਪਟਿਆਲੇ ਦੇ ਰਾਜਾ ਜੀ ਸੀਗੇ ਨਾ ਉਹਨਾਂ ਦਾ ਕਿਲ੍ਹਾ ਹੈਗਾ ਸਾਡੇ ਪਟਿਆਲੇ ਸ਼ਹਿਰ ਸਿਟੀ 'ਚ ਜਿਹੜੀ ਮਾਤਾ ਉਹਨਾਂ ਨੂੰ ਲੈ ਕੇ ਆਏ ਸੀ ਉਹਨਾਂ ਦਾ ਮੰਦਰ ਅਤੇ ਸਾਡਾ ਗੁਰਦੁਆਰਾ ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਇਹ ਪਟਿਆਲੇ ਦੀ ਫੇਮਸ ਜਗ੍ਹਾ ਨੇ ਤਿੰਨੋਂ ਜਾਂ ਫਿਰ ਤੁਸੀਂ ਲਾ ਲਉ ਪੰਜਾ ਪਟਿਆਲੇ ਦੀ ਜਿਹੜੀ ਏ ਸੀ ਮਾਰਕੀਟ ਹੈ ਪੰਜਾਬੀ ਸੂਟਾਂ ਲਈ ਅਤੇ ਜੁੱਤੀ ਲਈ ਫੇਮਸ ਹੈ ਠੀਕ ਠੀਕ ਹੈ ਸਰ ਓਕੇ ਕੋਈ ਨਹੀਂ ਸਰ ਕੋਈ ਨਹੀਂ